ਸਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਮਤਲਬ ਏਅਰਟੈੱਲ ਕੰਪਨੀ ਤੋਂ ਆਪਣਾ ਫ ਫੋਨ ਨੰਬਰ ਰੀਚਾਰਜ ਕਰਵਾਇਆ ਸੀ ਨੈਟ ਪੈਕ ਕਰਵਾਇਆ ਸੀ ਜੋ ਕਿ ਆ ਫੋਨ ਨੰਬਰ ਅ ਚੁਰਾਸੀ ਦੋ ਤੇਹੱਤਰ ਜੀਰੋ ਚਾਲੀ ਛਿਆਨਵੇਂ 'ਤੇ ਆ ਇਸ ਨੰਬਰ ਵਿੱਚ ਰਿਚਾਰਜ ਨਹੀਂ ਹੋਇਆ ਜੋ ਕਿ ਮਤਲਬ ਮੈਂ ਕੰਪਨੀ ਵਾਲਿਆਂ ਨੂੰ ਸ਼ਿਕਾਇਤ ਵੀ ਕਰੀ ਸੀ ਦੋ ਚਾਰ ਮਿੰਟ ਉਹ ਕਹਿੰਦੇ ਵੀ ਆ ਜਾਓ ਅਤੇ ਰੁਕ ਜਾਓ ਵੀ ਚੱਲ ਪਵੇਗਾ ਨੈੱਟ ਇਸ ਕਰਕੇ ਦੋ ਚਾਰ ਮਿੰਟ ਤੋਂ ਉਪਰ ਹੋ ਗਏ ਪੰਜ ਮਿੰਟ ਹੋ ਗਏ ਐਕਸਟਰਾ ਟਾਈਮ ਜੋ ਕਿ ਹਜੇ ਤੱਕ ਨਹੀਂ ਚੱਲਿਆ ਮੈਨੂੰ ਇਹ ਮੈਨੂੰ ਇਹ ਮੈਂ ਇਹ ਤੁਹਾਡੇ ਤੋਂ ਅਪੀਲ ਕਰਨਾ ਚਾਹੁੰਦੀ ਹਾਂ ਕਿ ਮੇਰੀ ਕ ਮੇਰੇ ਫੋ ਮਤਲਬ ਆਈਟ ਸਮੇਂ ਵਿੱਚ ਜਲਦੀ ਤੋਂ ਜਲਦੀ ਰਿਚਾਰਜ ਕਰ ਦਿੱਤੇ ਮੈਂ ਉਸ ਵਿੱਚ ਪੇਟੀ ਮਤਲਬ ਪੇਟੀਐਮ ਵੀ ਕਰਵਾਇਆ ਸੀ ਰੀਚਾਰਜ ਵਗੈਰਾ ਵਾਸਤੇ ਪੇਟੀਐਮ ਕਰਵਾਇਆ ਸੀ ਜੋ ਕਿ ਤੁਆ ਪੈਸੇ ਵੀ ਕੱਟੇ ਗਏ ਅਕਾਊਂਟ ਵਿੱਚ ਤਾਂ ਜਿਸ ਕਰਕੇ ਮੈਨੂੰ ਹੁਣ ਮਤਲਬ ਪ੍ਰੋਬਲਮ ਹੋ ਰਹੀ ਆ ਜਿਵੇਂ ਕੰਪਨੀ ਵਾਲਿਆਂ ਨੂੰ ਅਪੀਲ ਵੀ ਕੀਤੀ ਸੀ ਤੇ ਉਹਨਾਂ ਨੇ ਮੇਰੀ ਅਪੀਲ ਸਵੀਕਾਰ ਨਹੀਂ ਕੀਤੀ ਅਤੇ ਉਹਨਾਂ ਨੇ ਕਿਹਾ ਸੀ ਦੋ ਮਿੰਟ ਵਿੱਚ ਦਿਆਂਗੇ ਅਤੇ ਤੇ ਹੋਇਆ ਹੈ ਨਹੀਂ ਗਾ ਥੈਂਕ ਯੂ ਸਰ ਓਕੇ ਜਲਦੀ ਤੋਂ ਜਲਦੀ ਰੀਚਾਰਜ ਕਰਨ ਦੀ ਕਿਰਪਾਲਤਾ ਕਰੋ